ਮੈਂ ਲਗਭਗ ਸਾਰੇ ਸੋਸ਼ਲ ਮੀਡੀਆ ਪਲੇਟਫੋਰਮਾਂ ਦੀ ਵਰਤੋਂ ਕਰਦਾ ਹਾਂ ਉਹਨਾਂ ਵਿੱਚ ਫੇਸਬੁਕ ਆਉਂਦਾ ਵਟਸਐਪ ਆਉਂਦਾ ਟਵੀਟਰ ਆਉਂਦਾ ਅਤੇ ਇੰਸਟਾਗਰਾਮ ਆਉਂਦਾ ਇੰਸਟਾਗ੍ਰਾਮ 'ਤੇ ਰੀਲਾਂ ਵਗੈਰਾ ਆਉਂਦੀਆਂ ਨੇ ਉੱਥੇ ਤੋਂ ਵੀ ਅਸੀਂ ਜਾਣਕਾਰੀ ਲੈ ਸਕਦੇ ਹਾਂ ਕਿ ਕਿਹੜਾ ਟਰੈਂਡ ਦੁਨੀਆਂ ਦੇ ਵਿੱਚ ਚੱਲ ਰਿਹਾ ਇਹ ਤੋਂ ਇਲਾਵਾ ਜਿਹੜੇ ਫੇਸਬੁਕ ਅਤੇ ਟਵਿਟਰ ਨੇ ਇੱਥੇ ਜਾਣਕਾਰੀ ਥੋੜ੍ਹੀ ਔਥੈਂਟਿਕ ਹੁੰਦੀ ਆ ਅਤੇ ਚੀਜ਼ ਜਿਹੜੀ ਆ ਫਿਲਟਰ ਹੋ ਕੇ ਆਉਂਦੀ ਆ ਸਮਾਜ 'ਚ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹ ਇੱਥੇ ਦੱਸੀਆਂ ਜਾਂਦੀਆਂ ਨੇ ਉਹਤੋਂ ਮੈਨੂੰ ਪਤਾ ਲੱਗਦਾ ਕਿ ਸਾਡੇ ਸਮਾਜ ਦੇ ਵਿੱਚ ਕੀ ਕੀ ਵਾਪਰ ਰਿਹਾ ਕੀ ਕੀ ਚੇਂਜ ਆ ਰਹੇ ਨੇ ਕਿੱਥੇ ਕਿਹੜੀ ਘਟਨਾ ਘਟੀ ਹੈ ਉਹਦੇ ਬਾਰੇ ਮੈਨੂੰ ਸਭ ਕੁਝ ਪਤਾ ਲੱਗਦਾ ਅਤੇ ਜੇਕਰ ਦੇਖੀਏ ਕਿ ਵਿਸ਼ਵ ਦ੍ਰਿਸ਼ਟੀਕੋਣ ਨੂੰ ਮੇਰੇ ਨੂੰ ਉਹਨੇ ਕਿਵੇਂ ਕਰ ਦਿੱਤਾ ਉਹ ਐਵੇਂ ਐ ਕਿ ਅਲੱਗ ਅਲੱਗ ਸੋਸ਼ਲ ਮੀਡੀਆ ਅਕਾਊਂਟਾਂ ਤੋਂ ਜਿਹੜੇ ਮੇਰੇ ਨਾਲ ਦੂਜੇ ਦੁਨੀਆਂ ਦੇ ਦੂਜੀ ਦੁਨੀਆ ਕਹਿ ਲਓ ਕਿ ਦੂਜੀ ਕੰਟਰੀਆਂ ਦੇ ਲੋਕ ਜੁੜੇ ਨੇ ਉਹ ਆਪਣੇ ਵਿਚਾਰ ਪੇਸ਼ ਕਰਦੇ ਨੇ ਸਾਡੇ ਦੇਸ਼ ਦੇ ਲੋਕ ਆਪਣੇ ਵਿਚਾਰ ਪੇਸ਼ ਕਰਦੇ ਨੇ ਉਹਨਾਂ ਦੇ ਨਾਲ ਮੈਨੂੰ ਸਮਝ ਆਉਂਦੀ ਹੈ ਕਿ ਉਹ ਕਿਵੇਂ ਦੀ ਸੋਚ ਰੱਖਦੇ ਨੇ ਅਤੇ ਉਹਦੀ ਬੌਧਿਕਤਾ ਕਿਵੇਂ ਦੀ ਹੈ ਇਹਨਾਂ ਚੀਜ਼ਾਂ ਦੇ ਨਾਲ ਮੇਰਾ ਵਿਸ਼ਵ ਦ੍ਰਿਸ਼ਟੀਕੋਣ ਜਾਂ ਮੇਰਾ ਬੌਧਿਕ ਤਲ ਥੋੜ੍ਹਾ ਜਿਹਾ ਉੱਚਾ ਹੋ ਜਾਂਦਾ ਅਤੇ ਇਹ ਸੋਸ਼ਲ ਮੀਡੀਆ ਐਪ ਮੈਨੂੰ ਇਵੇਂ ਮਦਦ ਕਰਦੇ ਨੇ